ਕਿਸਾਨ ਖੇਤੀ ਕਰਨ ਲਈ ਸਰਕਾਰ ਤੋਂ ਕਰਜ਼ਾ ਲੈਂਦਾ ਹੈ ਲੇਕਿਨ ਉਸਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਪਿੰਡਾਂ ਵਿੱਚ ਸੁਸਾਇਟੀਆਂ ਬਣਾਈਆਂ ਜਾਂਦੀਆਂ ਹਨ ਜਿੱਥੋਂ ਉਹਨਾਂ ਨੂੰ ਕਰਜ਼ਾ ਮਿਲ ਸਕਦਾ ਹੈ